ਸਰਕਾਰ ਤੋਂ ਖੇਤੀ ਲਈ ਨਵੀਂ ਬਿਜਲੀ ਕੁਨੈਕਸ਼ਨ ਪ੍ਰਾਪਤ ਕਰਨ ਲਈ ਆਮ ਤੌਰ 'ਤੇ ਤੁਸੀਂ ਆਪਣੇ ਸਥਾਨਕ ਬਿਜਲੀ ਵਿਭਾਗ ਜਾਂਦੇ ਅਤੇ ਅਵੱਛਕ ਦਸਤਾਵੇਜ਼ ਅਤੇ ਮਨਜ਼ੂਰੀ ਦੀ ਪ੍ਰਕਿਰਿਆ ਮੁਕੰਮਲ ਕਰਨੀ ਪਵੇਗੀ ਇਸ ਵਿੱਚ ਆਮ ਤੌਰ 'ਤੇ ਜ਼ਮੀਨ ਦੀ ਮਾਲਕੀ ਦੀ ਪ੍ਰੋਫ ਜਾਂ ਲੀਜ਼ ਐਗਰੀਮੈਂਟ 'ਤੇ ਦੇਣੇ ਨੂੰ ਸ਼ ਸ਼ਾਮਿਲ ਕਰਨਾ ਪੈਣਗਾ ਸਾਥ ਹੀ ਐਪਲੀਕੇਸ਼ਨ ਫਾਰਮ ਭਰਨੀ ਪਵੇਗੀ ਵਧੇਰੇ ਵੱਖ ਵੱਖ ਖੇਤਰਾਂ ਅਤੇ ਨਿਯਮਾਂ ਦੇ ਅਧੀਨ ਵਿਚਾਰ ਕਾਰ ਵਿਚਾਰ ਕਾਰ ਮਿਤੀ ਅਤੇ ਸਿਖਰਮੀਆਂ ਵਰਤਣ ਲਈ ਪੂਰੇ ਪ੍ਰਕਿਰਿਆ ਵਿੱਚ ਮੁਕ ਮੁਕਾਬਲਾ ਕਰਨਾ ਪੈ ਸਕਦਾ ਹੈ